ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਦੁਕਾਨ ਵਿੱਚ ਸਵਾਗਤ ਵਧੀਆ ਜੀ ਵਧੀਆ ਤੁਹਾਡਾ ਦੁਕਾਨ ਵਿੱਚ ਸਵਾਗਤ ਹੈ ਜੀ ਹਾਂਜੀ ਦੱਸੋ ਕੀ ਸੇਵਾ ਕਰ ਸਕਦੇ ਹਾਂ ਜੀ ਬੜੇ ਚਿਰ ਬਾਅਦ ਗੇੜਾ ਮਾਰਿਆ ਵੀਰ ਤੁਸੀਂ ਹਾਂਜੀ ਹਾਂਜੀ ਇਹ ਵੀ ਗੱਲ ਹੈਗੀ ਉਹ ਕਾਕਾ ਸ਼ੂਜ਼ ਲੈ ਕੇ ਆ ਵੀਰ ਜੀ ਵਾਸਤੇ ਹਾਂਜੀ ਵੀਰ ਜੀ ਕਿਹੜੇ ਸ਼ੂਜ਼ ਚਾਹੀਦੇ ਤੁਹਾਨੂੰ ਸਪੋਰਟ ਸ਼ੂਜ਼ ਚਾਹੀਦੇ ਬੈਲੀ ਫੋਰਮਲ ਦੇ ਨਾਲ ਵੀਰੇ ਬੈਲੀ ਚਾਹੀਦੀ ਨਾ ਚਲ ਕੋਈ ਨਾ ਓ ਕਾਕਾ ਬੈਲੀ ਲੈ ਕੇ ਆ ਹਾਂਜੀ ਬਾਈ ਜੀ ਚਲੋ ਕੋਈ ਨਾ ਵੀਰੇ ਆ ਮੇਰੇ ਹੱਥ ਦਾ ਸਾਈਜ਼ ਕੀ ਵੀਰੇ ਅੱਠ ਨੰਬਰ ਕਿ ਨੌਂ ਨੰਬਰ ਨੌਂ ਨੰਬਰ ਆਹ ਪਾ ਕੇ ਵੇਖੋ ਫਿਰ ਮਾੜਾ ਜਿਹਾ ਟਾਈਟ ਆ ਰਿਹਾ ਕੋਈ ਨਾ ਵੀਰੇ ਤੁਸੀਂ ਆਹ ਚੈੱਕ ਕਰਕੇ ਵੇਖੋ ਇਹ ਪਿਓਰ ਲੈਦਰ 'ਚ ਆਹ ਚੈੱਕ ਕਰੋ ਵੀਰੇ ਆ ਤੋ ਪਿਓਰ ਲੈਦਰ ਦੇ ਵਿੱਚ ਵੁਡਨ ਸੋਲ ਹੈ ਕੋਈ ਵਾਟਰਪਰੂਫ ਮਤਲਬ ਕੁਛ ਨਹੀਂ ਆਵੇਗਾ ਨਾ ਟੁੱਟਣ ਦਾ ਡਰ ਨਾ ਕੋਈ ਉੱਧੜਨ ਦਾ ਡਰ ਬਾਕੀ ਅਸੀਂ ਬੈਠੇ ਦੁਕਾਨ 'ਤੇ ਕਲਰ ਵੀਰੇ ਕਿਹੜਾ ਚਾਹੀਦਾ ਇਹਦਾ ਬਰਾਊਨ ਏ ਤੁਹਾਨੂੰ ਬਲੈਕ 'ਚ ਚਾਹੀਦਾ ਬਲੈਕ 'ਚ ਆ ਮੇਰੇ ਆ ਲਓ ਵੀਰੇ ਬਲੈਕ 'ਚ ਕਲਰ ਲੈ ਲਓ ਸੇਮ ਟੂ ਸੇਮ ਹੈ ਇਹਦਾ ਤਲਾ ਵੀ ਦੇਖ ਲਓ ਵੂਡਨ ਸੋਲ ਏ ਸਾਰਾ ਕੁਝ ਲੈਦਰ ਏ ਉੱਧੜਨ ਦਾ ਡਰ ਕੋਈ ਪਾਣੀ ਤੋਂ ਨਹੀਂ ਇਹਨੂੰ ਪ੍ਰੋਬਲਮ ਹੈਗੀ ਚਲੋ ਵਾਟਰਪਰੂਫ ਬਾਕੀ ਇਹਦੀ ਮੈਟੇਨਸ ਪੂਰੀ ਕਰਨੀ ਦੇਖਭਾਲ ਤੁਸੀਂ ਕਰ ਸਕਦੇ ਹੋ ਬਾਕੀ ਆਪਣੀ ਵਰੰਟੀ ਵੀਰੇ ਇਹ ਨਾ ਇਹ ਆ ਕਿ ਜੇ ਘਰ ਲੈ ਕੇ ਜਾਓਗੇ ਤੁਹਾਨੂੰ ਨਹੀਂ ਪਸੰਦ ਆਉਂਦੀ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਬਾਕੀ ਟੁੱਟੇ ਦੀ ਅਸੀਂ ਕਹਿ ਸਕਦੇ ਮਤਲਬ ਜੇ ਤਲਾ ਉੱਖੜਦਾ ਏ ਤਾਂ ਉਸ ਵਿੱਚ ਸਾਡੀ ਗਰੰਟੀ ਏ ਬਾਕੀ ਟੁੱਟੇ ਦੀ ਕੋਈ ਸਾਡੀ ਗਰੰਟੀ ਨਹੀਂ ਹੈਗੀ

ਰੇਟ ਵੀਰੇ ਲੋਕਾਂ ਵਾਸਤੇ ਤਾਂ ਪੰਦਰ੍ਹਾਂ ਸੌ ਇਹ ਤੁਹਾਨੂੰ ਲਾ ਦਾਂਗੇ ਤੇਰ੍ਹਾਂ ਕੁ ਸੌ ਰੁਪਿਆ ਲੱਗ ਜਾਏਗਾ ਵੀਰੇ ਆਪਾਂ ਨੂੰ ਓ ਹੋ ਵੀਰੇ ਭਰਾਵਾਂ ਵਾਲੀ ਗੱਲ ਅੱਜ ਕੱਲ੍ਹ ਮਹਿੰਗਈ ਬਹੁਤ ਜ਼ਿਆਦਾ ਹੋ ਗਈ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਨਹੀਂ ਇਹਨੇ ਇਹਨੇ ਨਾਲ ਨਹੀਂ ਚੱਲਦਾ ਤੁਹਾਨੂੰ ਆਪ ਨੂੰ ਆਪਾਂ ਭਰਾ ਬਣ ਕੇ ਰੇਟ ਲਾ ਦਿੱਤਾ ਹੋਰ ਕੁਛ ਨਹੀਂ ਕਰ ਸਕਦੇ ਉਤੋਂ ਤੁਹਾਨੂੰ ਆਪਾਂ ਆਫਰ ਚੱਲ ਰਹੀ ਵੇਖੋ ਆਪਾਂ ਤੁਹਾਨੂੰ ਜੁਰਾਬਾਂ ਦੇ ਜੋੜੇ ਵੀ ਨਾਲ ਦੇ ਰਹੇ ਹਾਂ ਹਾਂਜੀ ਹਾਂਜੀ ਆ ਆਹ ਬੱਚੇ ਨੂੰ ਵੀ ਦੇਣੇ ਜੀ ਸ਼ੂਜ਼ ਆਹ ਬੱਚੇ ਦੀ ਬੱਚੇ ਦਾ ਚਲੋ ਕੋਈ ਨਹੀਂ ਬੱਚੇ ਨੂੰ ਕਿਹੜੇ ਦੇਣੇ ਜੀ ਅੱਛਾ ਬੱਚੇ ਵਾਸਤੇ ਸਪੋਰਟਸ ਸ਼ੂਜ਼ ਵੇਖਣੇ ਆਹ ਵੇਖੋ ਜੀ ਵੀਰੇ ਆਹ ਛੋਟੇ ਛੋਟੇ ਬੱਚਿਆਂ ਵਾਸਤੇ ਲਾਈਟਾਂ ਵਾਲੇ ਸ਼ੂਜ ਹੈਗੇ ਆ ਅੱਛਾ ਅੱਛਾ ਅੱਛਾ ਗੁੜੀਆ ਏ ਹਾਂਜੀ ਆਹ ਵੇਖੋ ਬੱਚੇ ਵਾਸਤੇ ਸ਼ੂਜ ਜਿਹਦੇ ਨਾਲ ਬੱਚਾ ਬਿਨਾਂ ਸੋਕਸ ਤੋਂ ਵੀ ਪਾ ਸਕਦਾ ਸ਼ੂਜ ਅਤੇ ਜਾਂ ਸੋਕਸ ਵੇਅਰ ਕਰਕੇ ਵੀ ਪਾ ਸਕਦਾ ਕੋਈ ਪ੍ਰੋਬਲਮ ਨਹੀਂ ਆਈ ਬੱਚੇ ਨੂੰ ਤੁਰਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਇਹ ਪੈਕ ਇਹ ਪੈਕ ਕਰਦਾ ਵੀਰੇ ਫਿਰ ਸ਼ੂਜ਼ ਇਹਨਾਂ ਦਾ ਵੀਰੇ ਇਹਨਾਂ ਦਾ ਹੈਗਾ ਇੱਕ ਸੌ ਅੱਸੀ ਰੁਪਈਏ ਤੁਹਾਡੇ ਵਾਸਤੇ ਪੂਰਾ ਜਾਇਜ ਜਾਇਜ ਲੋਕਾਂ ਨੂੰ ਢਾਈ ਸੌ ਰੁਪਈਆ ਲਾਈ ਦਾ ਤੁਹਾਨੂੰ ਇੱਕ ਸੌ ਅੱਸੀ ਰੁਪਈਏ ਲਾ ਦਿੱਤਾ ਕਿਉਂਕਿ ਬੱਚੇ ਦੇ ਸ਼ੂਜ ਆਪਾਂ ਬੱਚੇ ਦੇ ਵਿੱਚੋਂ ਕੋਈ ਮਾਰਜਨ ਨਹੀਂ ਰੱਖਣਾ ਚਾਹੁੰਦੇ ਇਸ ਕੰਮ 'ਚ ਬਾਕੀ ਜੇ ਜਿਨਦੇ ਬੱਚੇ ਦੇ ਸ਼ੂਜ਼ ਦੀ ਵੀਰੇ ਕੋਈ ਵਾਰੰਟੀ ਕਿਉਂਕਿ ਬੱਚੇ ਨੇ ਕਿਹੜਾ ਇੰਨਾਂ ਤੁਰਨਾ ਹੁੰਦਾ ਜਾਂ ਬੱਚੇ ਦੇ ਬੱਚੇ ਦੇ ਸ਼ੂਜ ਤਾਂ ਪਹਿਲਾਂ ਹੀ ਆਲਰੇਡੀ ਚੀਪ ਆਉਂਦੇ ਆ ਇਹ ਚੀੜੇ ਆਉਂਦੇ ਕਿ ਇਹਨਾਂ ਨੂੰ ਜਿੰਨਾਂ ਮਰਜ਼ੀ ਤੋੜੋ ਮਰੋੜੋ ਜੋ ਕੁਛ ਵੀ ਬੱਚੇ ਨੇ ਤਾਂ ਪਾਣੀ ਵਿੱਚ ਮਿੱਟੀ ਵਿੱਚ ਤੁਰੇ ਫਿਰਨਾ ਇਨਦੀ ਕੋਈ ਗਰੰਟੀ ਵਰੰਟੀ ਨਹੀਂ ਹੁੰਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਹੋਰ ਕੁਛ ਹੋਰ ਕੋਈ ਸੇਵਾ ਟੋਟਲ ਵੀਰੇ ਤੁਹਾਡਾ ਹੋ ਗਿਆ ਤੇਰ੍ਹਾਂ ਸੌ ਅਤੇ ਪਲੱਸ ਇੱਕ ਸੌ ਅੱਸੀ ਰੁਪਏ ਹੋ ਗਿਆ ਜੀ ਚੌਦ੍ਹਾਂ ਸੌ ਅੱਸੀ ਹੋ ਗਏ ਵੀਰੇ ਹਾਂਜੀ ਹਾਂਜੀ ਆ ਕੋਈ ਨਾ ਵੀਰੇ ਜਿੰਨੇ ਆ ਕੱਟ ਲਾ ਵੀਰੇ ਪੈਸੇ ਬੰਦੇ ਦੇ